ਮੇਰੇ ਨਾਲ ਇੱਕ ਵਾਰੀ ਮੈਂ ਬਚਪਨ ਤੋਂ ਦੌੜਨ ਦੀ ਬਹੁਤ ਸ਼ੌਕੀਨ ਹਾਂ ਨਾਲੇ ਮੇਰੇ ਇਸ ਦਿਲਚਸਪੀ ਨੂੰ ਵੇਖਦੇ ਹੋਏ ਮੇਰੇ ਘਰਦਿਆਂ ਨੇ ਮੈਨੂੰ ਦੌੜਨ ਦੀ ਪ੍ਰਤਿਭਾਗਿਆ ਵਿੱਚ ਵੀ ਪਾ ਕੇ ਰੱਖਿਆ ਹੋਇਆ ਸੀ ਪਰ ਜਦੋਂ ਹੁਣ ਮੈਂ ਦਸਵੀਂ ਪਾਸ ਕੀਤੀ ਵਿੱਚੋਂ ਮੈਂ ਦੌੜਨ ਦੀ ਪ੍ਰਤਿਭਾਗਿਆ ਵਿੱਚ ਹਿੱਸਾ ਲੈਣਾ ਬੰਦ ਕਰਤਾ ਸੀ ਹੁਣ ਮੈਂ ਬਾਹਰਵੀਂ ਵਿੱਚ ਵਾਪਸ ਆਈ ਹਾਂ ਅਤੇ ਦੌੜਨ ਦੀ ਪ੍ਰਤਿਯੋਗਤਾ ਵਿੱਚ ਵਾਪਸ ਭਾਗ ਲਿੱਤਾ ਸੀ ਮੈਂ ਪਰੰਤੂ ਵਿੱਚੋਂ ਇੱਕ ਸਾਲ ਗੈਪ ਪਾਉਣ ਦੇ ਕਾਰਨ ਮੇਰੇ ਵਿੱਚ ਬਹੁਤ ਕਮੀਆਂ ਆ ਚੁੱਕੀਆਂ ਸਨ ਇਹ ਇੱਕ ਹਾਦਸਾ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਇੱਕ ਵਾਰੀ ਇਹ ਹੋਇਆ ਸੀ ਕਿ ਮੈਂ ਬਾਰ੍ਹਵੀਂ ਵਿੱਚ ਹੁਣ ਜਿਵੇਂ ਦੋ ਕੁ ਦਿਨਾਂ ਪਹਿਲੇ ਹੀ ਦੌੜਨ ਦੀ ਆਪਦੀ ਪ੍ਰਤਿਯੋਗਤਾ ਵਿੱਚ ਹੈਗੀ ਸੀ ਉਹ ਸੌ ਮੀਟਰ ਦੀ ਇੱਕ ਪ੍ਰਤਿਯੋਗਿਤਾ ਸੀ ਜਿਹਦੇ ਵਿੱਚ ਤੁਹਾਨੂੰ ਪਹਿਲੇ ਸੌ ਮੀਟਰ ਭੱਜਣਾ ਪੈਂਦਾ ਹੈ ਤਾਂ ਜਾ ਕੇ ਤੁਸੀਂ ਮੇਨ ਮੈਰਾਥਨਸਟਿਕ ਕੁਆਲੀਫਾਈ ਹੋ ਸਕਦੇ ਹੋ ਸੌ ਮੀਟਰ ਵਾਲੀ ਤਾਂ ਮੈਂ ਭੱਜ ਲਿਤੀ ਅਤੇ ਜਦੋਂ ਮੈਰਥਨ ਦੀ ਵਾਰੀ ਆਈ ਉਸਦਾ ਜਿਹੜਾ ਰੂਟ ਸੀ ਮੈਂ ਉਸ ਰੂਟ ਨੂੰ ਹੀ ਭੁੱਲ ਬੈਠੀ ਉਹ ਇੱਕ ਸ਼ਹਿਰ ਵਿੱਚ ਪੂਰੀ ਵੱਡੀ ਮੈਰਥਨ ਹੈਗੀ ਸੀ ਜਿਸ ਦੇ ਵਿੱਚ ਸਾਨੂੰ ਚੰਡੀਗੜ੍ਹ ਵਿੱਚ ਹੈਗਾ ਸੀ ਉਹ ਉੱਥੇ ਜਿਸ ਦੇ ਵਿੱਚ ਸਾਨੂੰ ਕਈ ਸੈਕਟਰ ਕਵਰ ਕਰਨੇ ਸੀ ਪਰੰਤੂ ਮੈਂ ਵਿੱਚੋਂ ਇੱਕ ਸੈਕਟਰ ਨੂੰ ਸਕਿਪ ਕਰਕੇ ਦੂਜੇ ਪਾਸੇ ਇਕੱਲੀ ਭੱਜਣ ਜਾਂਦੀ ਤਾਂ ਮੈਨੂੰ ਲੱਗਿਆ ਕਿ ਮੈਂ ਸਭ ਤੋਂ ਅੱਗੇ ਹਾਂ ਪਰੰਤੂ ਬਾਅਦ ਵਿੱਚ ਮੈਨੂੰ ਜਾ ਕੇ ਪਤਾ ਚੱਲਿਆ ਕਿ ਸਾਰੇ ਦੂਜੇ ਪਾਸੇ ਹੀ ਹਨ ਅਤੇ ਮੈਂ ਹੀ ਗਲਤ ਜਾ ਰਹੀ ਸੀ ਜਿਸਦੇ ਕਰਕੇ ਮੈਂ ਪ੍ਰਤਿਯੋਗਤਾ ਵਿੱਚ ਭਾਵੇਂ ਆ ਤਾਂ ਮੈਂ ਫਿਰ ਵੀ ਸੈਕਿੰਡ ਗਈ ਪਰੰਤੂ ਮੇਰਾ ਫਰਸਟ ਆਉਣ ਦਾ ਸੁਪਨਾ ਸੁਪਨਾ ਹੀ ਰਹਿ ਗਿਆ ਪਰੰਤੂ ਇਹ ਬਹੁਤ ਹਾਸੇ ਵਾਲੀ ਚੀਜ਼ ਮੈਨੂੰ ਉਸ ਸਮਾਂ ਵੀ ਲੱਗੀ ਸੀ ਅਤੇ ਹਮੇਸ਼ਾ ਹੀ ਲੱਗੇਗੀ